ਮੈਨੂੰ ਜੀ ਐਸ ਟੀ ਵਿਭਾਗ ਤੋਂ ਇੱਕ ਨੋਟਿਸ ਪ੍ਰਾਪਤ ਹੋਈ ਹੈ ਜਿਸ ਵਿੱਚ ਮੇਰੀ ਟੈਕਸ ਫਾਇਲਿੰਗ ਵਿੱਚ ਕੁਛ ਗੜਬੜਾਂ ਦੀ ਗਲਤ ਫ਼ਹਿਮੀ ਦੱਸੀਆਂ ਗਈਆਂ ਹਨ ਇਸ ਨੋਟਿਸ ਵਿੱਚ ਸਪੱਸ਼ਟ ਦੱਸਿਆ ਗਿਆ ਹੈ ਕਿ ਮੇਰੇ ਦਾਖਲ ਕੀਤੇ ਟੈਕਸ ਰਿਟਰਨ ਵਿੱਚ ਕੁਛ ਜਾਣਕਾਰੀ ਸਹੀ ਨਹੀਂ ਹੈ ਇਸ ਕਰਕੇ ਇਹ ਗੜਬੜ ਪੈਦਾ ਹੋਈ ਹੈ ਮੈਨੂੰ ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਚਿੰਤਾ ਹੋਈ ਹੈ ਕਿ ਕਿਉਂਕਿ ਮੇਰੀ ਕੋਸ਼ਿਸ਼ ਹਮੇਸ਼ਾ ਹੀ ਸਹੀ ਅਤੇ ਸਚੁੱਲਾ ਟੈਕਸ ਦਾਖਲ ਕਰਨ ਦੀ ਰਹੀ ਹੈ ਮੈਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹਾਂ ਅਤੇ ਚਾਹੁੰਦੀ ਹਾਂ ਕਿ ਇਹ ਗਲਤ ਫ਼ਹਿਮੀ ਜਲਦ ਤੋਂ ਜਲਦ ਦੂਰ ਹੋ ਜਾਵੇ ਇਸ ਲਈ ਮੈਂ ਜੀ ਐਸ ਟੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਸੂਚਨਾ ਦਿੰਦੀ ਹਾਂ ਤਾਂ ਜੋ ਮੈਂ ਇਸ ਗੜਬੜ ਦੀ ਮਦਦ ਨਾਲ ਪੂਰੀ ਤਰ੍ਹਾਂ ਜਾਂਚ ਕਰ ਸਕਾਂ ਅਤੇ ਜੇ ਕੋਈ ਗਲਤੀ ਹੋਈ ਹੈ ਤਾਂ ਉਸਨੂੰ ਸਹੀ ਕਰਾਂ ਇਸ ਮਾਮਲੇ ਨੂੰ ਸਹੀ ਕਰਨ ਲਈ ਮੈਂ ਅਧਿਕਾਰੀਆਂ ਦੀ ਪੂਰੀ ਮਦਦ ਲੈਣ ਦੀ ਇੱਛਾ ਰੱਖਦੀ ਹਾਂ ਅਤੇ ਉਹ ਸਾਰੀ ਜਾਣਕਾਰੀ ਜਾਂ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਤਿਆਰ ਹਾਂ ਜੋ ਕਿ ਇਸ ਗੜਬੜੀ ਨੂੰ ਹੱਲ ਕਰਨ ਲਈ ਲੋੜੀਂਦੇ ਹੋਣਗੇ ਮੈਂ ਇਹ ਵੀ ਬੇਨਤੀ ਕਰਦੀ ਹਾਂ ਕਿ ਮੈਨੂੰ ਇਹ ਸਮਝਾਇਆ ਜਾਵੇ ਕਿ ਇਸ ਗਲਤ ਫ਼ਹਿਮੀ ਦੇ ਪਿੱਛੇ ਦੀ ਕਾਰਨ ਕੀ ਹੈ ਤਾਂ ਜੋ ਮੈਂ ਭਵਿੱਖ ਵਿੱਚ ਇਹਨਾਂ ਗਲਤੀਆਂ ਨੂੰ ਦੁਹਰਾਉਣ ਤੋਂ ਬਚ ਸਕਾਂ ਇਹ ਇਹ ਨੋਟਿਸ ਮਿਲਣ ਤੋਂ ਮੈਂ ਪੂਰੀ ਤਰ੍ਹਾ ਸਹਿਯੋਗ ਦੇਣ ਲਈ ਤਿਆਰ ਹਾਂ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਜੀ ਐਸ ਟੀ ਵਿਭਾਗ ਵਿੱਚ ਗਲਤ ਫ਼ਹਿਮੀ ਨੂੰ ਸਹੀ ਕਰਨ ਵਿੱਚ ਮੇਰੀ ਮਦਦ ਕਰੇਗਾ ਮੈਂ ਕਿਰਪਾ ਕਰਕੇ ਮਾਮਲੇ ਨੂੰ ਹੱਲ ਕਰਨ ਲਈ ਵਾਧੂ ਮਾਰਗ ਦਰਸ਼ਨ ਦੀ ਬੇਨਤੀ ਕਰਦੀ ਹਾਂ ਅਤੇ ਮੈਂ ਆਪਣੇ ਸੀ ਏ ਜਿਸ ਤੋਂ ਆਪਣੀ ਜੀ ਐਸ ਟੀ ਦੀ ਫਾਈਲਿੰਗ ਕਰਵਾਉਂਦੀ ਹਾਂ ਉਸ ਨਾਲ ਗੱਲ ਜ਼ਰੂਰ ਕਰਾਂਗੀ ਅਤੇ ਆਪਣੀ ਇਸ ਗੜਬੜੀ ਦੇ ਬਾਰੇ ਜ਼ਰੂਰ ਗੱਲਬਾਤ ਦੀ ਗਲਤ ਫ਼ਹਿਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੀ ਮੈਨੂੰ ਕਿਰਪਾ ਕਰਕੇ ਮਾਮਲੇ ਦੀ ਹੱਲ ਕਰਨ ਲਈ ਵਾਧੂ ਮਾਰਗ ਦਰਸ਼ਨ ਕਰਨ ਦੀ ਬੇਨਤੀ ਕਰਦੀ ਹਾਂ ਮੈਂ ਚਾਹੁੰਦੀ ਹਾਂ ਕਿ ਜੀ ਐਸ ਟੀ ਦੇ ਅਧਿਕਾਰੀ ਮੇਰੀ ਮਦਦ ਕਰਨ ਤਾਂ ਜੋ ਮੈਂ ਭਵਿੱਖ ਵਿੱਚ ਹੋਣ ਵਾਲੀ ਇਹਨਾਂ ਗਲਤੀਆਂ ਨੂੰ ਦੁਬਾਰਾ ਦੁਹਰਾਉਣ ਤੋਂ ਬਚ ਸਕਾਂ